ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਹੈ ਜੋ ਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਇਆ ਗਿਆ ਹਰਿਮੰਦਰ ਸਾਹਿਬ ਹੈ ਮੈਨੂੰ ਆਪਣੇ ਪਰਿਵਾਰ ਨਾਲ ਆਉਣ ਦਾ ਅਤੇ ਇਕੱਲੇ ਵੀ ਕਾਫ਼ੀ ਵਾਰੀ ਮੌਕਾ ਮਿਲਿਆ ਆਉਣ ਦਾ ਅਤੇ ਬਹੁਤ ਹੀ ਸਕੂਨ ਮਿਲਦਾ ਆ ਕੇ ਅਤੇ ਅਸੀਂ ਪਹਿਲਾਂ ਇਸ਼ਨਾਨ ਕਰਦੇ ਹਾਂ ਫਿਰ ਮੱਥਾ ਟੇਕਦੇ ਹਾਂ ਮੱਥਾ ਟੇਕਣ ਤੋਂ ਘੱਟੋ ਘੱਟ ਵੀ ਦੋ ਤਿੰਨ ਘੰਟੇ ਸਾਨੂੰ ਲਾਈਨ 'ਚ ਲੱਗਣਾ ਪੈਂਦਾ ਇੰਨਾ ਲੱਗਣਾ ਪੈਂਦਾ ਅਤੇ ਜੋ ਬਿਰਧ ਹੁੰਦੇ ਆ ਮਾਤਾ ਭੈਣ ਜਾਂ ਕੋਈ ਬਜ਼ੁਰਗ ਉਹਨਾਂ ਨੂੰ ਥੋੜ੍ਹਾ ਟਾਈਮ ਘੱਟ ਲੱਗਦਾ ਉਹਨਾਂ ਨੂੰ ਹੋਰ ਲਾਈਨ 'ਚ ਲਾ ਦਿੰਦੇ ਹੈਗੇ ਅਤੇ ਲੰਗਰ ਲਈ ਵੀ ਸਾਨੂੰ ਕਾਫ਼ੀ ਟਾਈਮ ਲੱਗਦਾ ਪਰ ਸਕੂਨ ਬਹੁਤ ਮਿਲਦਾ ਮਨ ਨੂੰ ਬਹੁਤ ਸ਼ਾਂਤੀ ਆਉਂਦੀ ਹੈ ਬੰਦਾ ਹੋਰ ਚੀਜ਼ਾਂ ਆਸ ਪਾਸ ਦੀਆਂ ਸਾਰੀਆਂ ਭੁੱਲ ਜਾਂਦਾ ਉੱਥੇ ਜਾ ਕੇ ਅਤੇ ਬਹੁਤ ਹੀ ਸਕੂਨ ਮਿਲਦਾ ਮਨ ਨੂੰ ਹਾਂਜੀ